ਪੰਜਾਬੀ ਭਾਸ਼ਾ ਜੋ ਕਿ ਪੰਜਾਬ ਦੀ ਮਾਂ ਬੋਲੀ ਹੈ ਅੱਜ ਬਹੁਤ ਸਾਰੀਆਂ ਯੂਨੀਵਰਸਿਟੀਆਂ ਉਹ ਸਮਾਜ ਦੇ ਉੱਘੇ ਵਿਦਵਾਨ ਸਾਹਿਤਕਾਰ ਪੰਜਾਬੀ ਨੂੰ ਬਚਾਉਣ ਲਈ ਸੜਕਾਂ 'ਤੇ ਆ ਰਹੇ ਹਨ ਵਿਦਵਾਨ ਸੋਸ਼ਲ ਮੀਡੀਆ 'ਤੇ ਪੇਜ ਲਿਖ ਕੇ ਲਿਖ ਲਿਖ ਕੇ ਇਸ ਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕਰ ਰਹੇ ਨੇ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਪੰਜਾਬ ਸਰਕਾਰ ਨੇ ਵੀ ਬਹੁਤ ਵਧੀਆ ਉਪਰਾਲਾ ਕੀਤਾ ਹੈ ਪੰਜਾਬ ਸਰਕਾਰ ਨੇ ਕਾਨੂੰਨ ਬਣਾਇਆ ਹੋਇਆ ਵੀ ਸਾਰੇ ਸਕੂਲਾਂ ਦੇ ਵਿੱਚ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਜਦੋਂ ਕਿ ਪ੍ਰਾਈਵੇਟ ਸੰਸਥਾਵਾਂ ਦੇ ਵਿੱਚ ਵੀ ਸਰਕਾਰ ਨੇ ਬੜੀ ਸਖਤੀ ਨਾਲ ਪੰਜਾਬੀ ਲਾਗੂ ਕਰਨ ਦੇ ਯਤਨ ਕੀਤੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਧਿਆਨ ਦੇ ਵਿੱਚ ਆਉਂਦਾ ਵੀ ਸ ਜਿਹੜੇ ਕੋਂਨਵੇਟ ਸਕੂਲ ਨੇ ਆਪਣੇ ਆਪ ਨੂੰ ਅੰਗਰੇਜ਼ੀ ਮੀਡੀਅਮ ਦੇ ਸਕੂਲ ਕਹਾਉਂਦੇ ਨੇ ਉੱਘੇ ਨਾਮਵਰ ਸਕੂਲ ਨੇ ਉਹਨਾਂ ਦੇ ਵਿੱਚ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਜ਼ੁਰਮਾਨਾ ਕੀਤਾ ਜਾਂਦਾ ਹੈ ਇਹ ਕਿਤੇ ਨਾ ਕਿਤੇ ਮਾਪਿਆਂ ਦੇ ਵਿੱਚ ਗੱਲ ਸੁਣਨ ਨੂੰ ਮਿਲਦੀ ਹੈ ਅਤੇ ਇੱਥੇ ਸ ਇਹ ਵੀ ਸਾਡਾ ਆਪਣਾ ਵੀ ਫਰਜ਼ ਬਣਦਾ ਹੈ ਵੀ ਸਰਕਾਰ ਦੇ ਧਿਆਨ ਵਿੱਚ ਲਿਆਈਏ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਈਏ ਵੀ ਇਹਨਾਂ ਸਕੂਲਾਂ ਦੇ ਵਿੱਚ ਸਖਤੀ ਨਾਲ ਪੰਜਾਬੀ ਨੂੰ ਲਾਗੂ ਕਰਵਾਇਆ ਜਾਵੇ ਪੰਜਾਬ ਹੀ ਨਹੀਂ ਹਰਿਆਣਾ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਹਰਿਆਣਾ ਜੋ ਕਿ ਪੰਜਾਬ ਦਾ ਹੀ ਹਿੱਸਾ ਹੈ ਆਪਾਂ ਨੂੰ ਪਤਾ ਹੀ ਹੈ ਉੱਨੀ ਸੌ ਛਿਆਹਟ ਦੇ ਵਿੱਚ ਹਰਿਆਣਾ ਅਲੱਗ ਹੋ ਗਿਆ ਸੀਗਾ ਇੱਕ ਨਵੰਬਰ ਇਸ ਕਰਕੇ ਹਰਿਆਣਾ ਦੇ ਵਿੱਚ ਵੀ ਪੰਜਾਬੀ ਨੂੰ ਦੂਜੀ ਭਾਸ਼ਾ ਦਰਜਾ ਦਿੱਤਾ ਗਿਆ ਹੈ ਪੰਜਾਬੀ ਪੰਜਾਬ 'ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਕਨੇਡਾ ਵਿੱਚ ਹੀ ਨਹੀਂ ਜਿੱਥੇ ਵੀ ਵਿਦੇਸ਼ੀ ਪੰਜਾਬੀ ਵਸਦੇ ਨੇ ਅੱਜ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਆਪਣੇ ਆਪਣੇ ਪੱਧਰ 'ਤੇ ਸਭਾਵਾਂ ਬਣਾ ਕੇ ਐਨ ਜੀ ਓ ਬਣਾ ਕੇ ਕੰਮ ਕਰ ਰਹੇ ਨੇ ਸਾਨੂੰ ਵੀ ਹਰ ਰੋਜ਼ ਪੰਜਾਬੀ ਲਿਖਣੀ ਚਾਹੀਦੀ ਹੈ ਪੜਨੀ ਚਾਹੀਦੀ ਹੈ ਤਾਂ ਜੋ ਅਸੀਂ ਇਸ ਡਿਜੀਟਲ ਮੀਡੀਆ ਦੇ ਦੌਰ ਦੇ ਵਿੱਚ ਕਿਤੇ ਆਪਣੀ ਬੋਲੀ ਨੂੰ ਵਿਸਾਰੀਏ ਨਾ ਜਾਈਏ ਭੁੱਲ ਹੀ ਨਾ ਜਾਈਏ ਕਿਉਂਕਿ ਜ਼ਿਆਦਾਤਰ ਕੰਮ ਤੁਸੀਂ ਵੇਖਿਆ ਵੀ ਅੱਜ ਕੱਲ੍ਹ ਅੰਗਰੇਜ਼ੀ ਦੇ ਵਿੱਚ ਹੋ ਰਿਹਾ ਡਿਜੀਟਾਈਲੇਸ਼ਨ ਸੋਸ਼ਲ ਮੀਡੀਆ ਅਤੇ ਅੰਗਰੇਜ਼ੀ ਦਾ ਦੌਰ ਹੈ ਆਪਾਂ ਮੇਲ ਲਿਖਦੇ ਹਾਂ ਆਪਾਂ ਜ਼ਿਆਦਾਤਰ ਕੰਮ ਸਹਿਜ ਸੁਭਾਵਕ ਜਾਂ ਤਾਂ ਸਹਿਜ ਸੁਭਾਵਿਕ ਕਰਦੇ ਹਾਂ ਅੰਗਰੇਜ਼ੀ 'ਚ ਜਾਂ ਆਪਾਂ ਕਿਸੇ ਦਫ਼ਤਰ ਦੇ ਵਿੱਚ ਜਿੱਥੇ ਕੰਮ ਕਰਦੇ ਹਾਂ ਆਪਾਂ ਨੂੰ ਕਰਨਾ ਪੈਂਦਾ ਸਾਡੀ ਮਜ਼ਬੂਰੀ ਹੈ ਪਰ ਫਿਰ ਵੀ ਅਸੀਂ ਪੰਜਾਬੀ ਭਾਸ਼ਾ ਨੂੰ ਕਦੇ ਵੀ ਨਹੀਂ ਭੁੱਲ ਸਕਦੇ ਅਤੇ ਧੰਨਵਾਦ ਹੈ ਉਹਨਾਂ ਅਖ਼ਬਾਰਾਂ ਦਾ ਜਿਹੜੇ ਅੱਜ ਡਿਜੀਟਾਈ ਰਾਹੀਂ ਰ ਰਾਹੀਂ ਈ ਪੇਪਰ ਚਲਾ ਕੇ ਅਖ਼ਬਾਰ ਚਲਾ ਕੇ ਧੰਨਵਾਦ ਹੈ ਉਹਨਾਂ ਸੰਸਥਾਵਾਂ ਦਾ ਸਾਹਿਤਕ ਸੰਸਥਾਵਾਂ ਦਾ ਜਿਹੜੀਆਂ ਸਮੇਂ ਸਮੇਂ 'ਤੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਪੁਸਤਕ ਮੇਲੇ ਲਾਉਂਦੀਆਂ ਰਹੀਆਂ ਨੇ ਨੌਜਵਾਨਾਂ ਤੱਕ ਪੰਜਾਬੀ ਸਾਹਿਤ ਪਹੁੰਚਾਉਂਦੀਆਂ ਨੇ ਇਨਾਂ ਉਪਰਾਲਿਆਂ ਕਰਕੇ ਹੀ ਪੰਜਾਬੀ ਬਚ ਸਕਦੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਪੁੱਛਿਆ ਕਰਨਗੇ ਵੀ ਪੰਜਾਬੀ ਹੁੰਦੀ ਕੀ ਹੈ ਇਹ ਕਿਹੜੀ ਭਾਸ਼ਾ ਹੈ ਜੇ ਅਸੀਂ ਪੰਜਾਬੀ ਨੂੰ ਬਚਾਉਣਾ ਹੈ ਤਾਂ ਪੰਜਾਬੀ ਨੂੰ ਨਿਰੰਤਰ ਬੋਲਣਾ ਪਏਗਾ ਨਿਰੰਤਰ ਲਿਖਣਾ ਪੜੇਗਾ ਨਿਰੰਤਰ ਪੜਨਾ ਪਊਗਾ